ਸਤਿ ਸ਼੍ਰੀ ਅਕਾਲ ਭਾਅ ਜੀ ਅਨੰਤ ਟੈਕਸੀ ਤੋਂ ਗੱਲ ਕਰ ਰਹੇ ਹੋ ਮੇਰਾ ਨਾਮ ਪੁਨੀਤ ਸ਼ਰਮਾ ਹੈ ਮੈਂ ਸਦਰ ਥਾਣੇ ਤੋਂ ਗੱਲ ਕਰ ਰਹੀ ਹਾਂ ਕੱਲ੍ਹ ਨਾ ਮੇਰੇ ਬ੍ਰਦਰ ਦੀ ਫਲਾਈਟ ਹੈ ਇਸ ਕਰਕੇ ਮੈਂ ਤੁਹਾਡੀ ਟੈਕਸੀ ਬੁੱਕ ਕਰਨੀ ਸੀ ਅਸੀਂ ਰੋਪੜ ਤੋਂ ਚੰਡੀਗੜ੍ਹ ਜਾਣਾ ਹੈ ਜਿਹੜਾ ਜਾਣ ਦਾ ਸਮੇਂ ਅਸੀਂ ਦਸ ਵਜੇ ਜਿਹੜਾ ਘਰ ਤੋਂ ਨਿਕਲਣਾ ਹੈ ਇਸ ਕਰਕੇ ਮੇਰੇ ਮਾਤਾ ਪਿਤਾ ਜਿਹੜੇ ਮੇੇਰੇ ਨਾਲ ਹੈ ਅਤੇ ਮੇਰਾ ਬ੍ਰਦਰ ਹੈ ਅਤੇ ਇੱਕ ਮੇਰਾ ਛੋਟਾ ਕਜ਼ਨ ਹੈ ਅਤੇ ਅਸੀਂ ਜਾਂਦੇ ਹੋਏ ਰਸਤੇ 'ਚ ਇੱਕ ਪਹਿਲਵਾਨ ਢਾਬਾ ਹੈ ਸਿਰਫ ਉੱਥੇ ਰੁਕਣਾ ਹੈ ਅਤੇ ਉਸ ਤੋਂ ਬਾਅਦ ਅਸੀਂ ਸਿੱਧਾ ਜਿਹੜਾ ਹੈ ਜਲਦੀ ਤੋਂ ਜਲਦੀ ਏਅਰਪੋਰਟ ਪੁੱਜਣਾ ਹੈ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਾਨੂੰ ਇੱਕ ਵਜੇ ਤੱਕ ਉੱਥੇ ਪੁੱਜਾ ਸਕਦੇ ਹੋ ਅਤੇ ਤੁਹਾਡਾ ਕੀ ਕਿਰਾਇਆ ਹੈ ਇਹ ਤੁਸੀਂ ਦੱਸ ਦਿਉ ਧੰਨਵਾਦ